ਹੈਲੋ ਹਾਂਜੀ ਹਾਂਜੀ ਸਿਮਰਨਪ੍ਰੀਤ ਬੋਲ ਰਹੀ ਹਾਂ ਮੈਂ ਮੈਮ ਮੈਨੂੰ ਯਾਦ ਨਹੀਂ ਹੈ ਮੈਂ ਨਹੀਂ ਕੀਤਾ ਹੋਣਾ ਸ਼ਾਇਦ ਕੋਈ ਮਿਸਟੇਕ ਹੋਈ ਹੈ

ਠੀਕ ਹੈ ਮੈਮ ਠੀਕ ਹੈ ਮੈਂ ਆ ਜਾਂਗੀ ਮੈਂ ਕੱਲ੍ਹ ਆ ਜਾਂਗੀ ਓਕੇ ਓਕੇ ਮੈਮ ਓਕੇ